ਸਾਡੇ ਖੇਤਰ ਵਿੱਚ ਅਕਸਰ ਦੇਖੇ ਜਾਣ ਵਾਲੇ ਬਹੁਤ ਪੰਛੀ ਹਨ ਜਿਵੇਂ ਕਿ ਮੋਰ ਹੋ ਗਿਆ ਕਬੂਤਰ ਤੋਤਾ ਹੋਰ ਵੀ ਆਦਿ ਪੰਛੀ ਹਨ ਇਹ ਹਰ ਇੱਕ ਖੇਤਰ ਵਿੱਚ ਦੇਖੇ ਜਾਂਦੇ ਹਨ ਸਾਡੇ ਇੱਥੇ ਜਿਵੇਂ ਚੰਡੀਗੜ੍ਹ ਵਿੱਚ ਜੂ ਹੈ ਉਸ ਵਿੱਚ ਵੀ ਸਾਨੂੰ ਕਾਫੀ ਪੰਛੀਆਂ ਜਾਨਵਰਾਂ ਦੇਖਣ ਨੂੰ ਮਿਲਦੇ ਹਨ ਮੇਰਾ ਮਨ ਪਸੰਦ ਪੰਛੀ ਮੋਰ ਹੈ ਮੋਰ ਸਾਨੂੰ ਇਹ ਮਤਲਬ ਕਿ ਇੱਥੇ ਸਾਨੂੰ ਘੱਟ ਤੋਂ ਘੱਟ ਦਿਖਦਾ ਇਹ ਸਾਨੂੰ ਮਤਲਬ ਕਿ ਸਾਡੇ ਇੱਥੇ ਇਲਾਕੇ ਵਿੱਚ ਪਹਾੜੀ ਏਰੀਆ ਹੈਗਾ ਏ ਜੇ ਅਸੀਂ ਕਿਤੇ ਪਹਾੜੀ ਏਰੀਆ ਵਿੱਚ ਘੁੰਮਣ ਜਾਂਦੇ ਆ ਜੰਗਲਾਂ ਵਿੱਚ ਘੁੰਮਣ ਜਾਂਦੇ ਆ ਤਾਂ ਇੱਥੇ ਸਾਨੂੰ ਦੇਖਣ ਨੂੰ ਮਿਲਦਾ ਏ ਸਾਨੂੰ ਮੋਰ ਮੋਰਨੀ ਇਹ ਸਾਨੂੰ ਦੇਖਣ ਨੂੰ ਮਿਲਦਾ ਇਹਨਾਂ ਦੇ ਜੋੜੇ ਦੇਖਣ ਨੂੰ ਮਿਲਦੇ ਇਹਨਾਂ ਦੇ ਪੰਖ ਸਤਰੰਗੀ ਹੁੰਦੇ ਇਹਨਾਂ ਦਾ ਪੰਖ ਮੋਰ ਦੇ ਪੰਖ ਬਹੁਤ ਵਧੀਆ ਹੁੰਦੇ ਨੇ ਸੋਹਣੇ ਇਹਨਾਂ ਦੀ ਬਨਾਵਟ ਇੰਨੀ ਸੋਹਣੀ ਹੁੰਦੀ ਹੈ ਕਿ ਕਿਸੇ ਦਾ ਵੀ ਮਨ ਮੋਹ ਲੈਂਦੇ ਹਨ ਇਹ ਮਤਲਬ ਕਿ ਇਹ ਸਾਡਾ ਰਾਸ਼ਟਰੀ ਪੰਛੀ ਹੈ ਜੋ ਕਿ ਇਹ ਸਾਰਿਆਂ ਦਾ ਮਨਮੋਹਕ ਹੁੰਦਾ ਸਭ ਨੂੰ ਇਹ ਪੰਛੀ ਪਿਆਰਾ ਹੁੰਦਾ ਏ